ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਹੈ ਅਤੇ ਕੁੜੀਆਂ ਲਈ ਗਿੱਧਾ ਪੰਜਾਬ ਦੇ ਤਿੰਨ ਖੇਤਰਾਂ ਨਾਂ ਮਾਝਾ ਮਾਲਵਾ ਦੋਆਬਾ ਅਤੇ ਨਾਲ਼ ਹੀ ਛੋਟਾ ਜਿਹਾ ਇਲਾਕਾ ਪੁਆਧ ਵੀ ਪਾਇਆ ਜਾਂਦਾ ਹੈ ਮਾਲਵੇ ਦਾ ਮਲਵਈ ਗਿੱਧਾ ਬਹੁਤ ਹੀ ਫੇਮਸ ਹੈ ਅਤੇ ਮਾਝੇ ਦੀ ਬੋਲੀ ਜਿਹੜੀ ਕਿ ਠੇਠ ਪੰਜਾਬੀ ਮੰਨੀ ਜਾਂਦੀ ਹੈ ਪੰਜਾਬ ਦੇ ਲੋਕ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਹੈ ਅਤੇ ਪੰਜਾਬ ਦੇ ਸੂਰਵੀਰਾਂ ਦੇ ਬਹੁਤ ਹੀ ਕਿੱਸੇ ਪਾਏ ਜਾਂਦੇ ਹਨ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਪੰਜਾਬ ਵਿੱਚ ਬਹੁਤ ਸਾਰੇ ਸੂਰਵੀਰ ਜ ਬਹੁਤ ਹੋਏ ਹਨ ਜਿਹਨਾਂ ਦਾ ਇਤਿਹਾਸ ਅੱਜ ਵੀ ਕਈ ਕਿਤਾਬਾਂ ਕਿਵੇਂ ਉਹਨਾਂ ਦੇ ਉਹਨਾਂ ਦੇ ਜਿੱਥੇ ਰਹਿੰਦੇ ਸੀ ਉਹ ਭਾਗਾਂ ਵਿੱਚ ਮਿਲਦਾ ਹੈ ਜਿਵੇਂ ਕਿ ਦੇਖਿਆ ਜਾਵੇ ਸੰਗਰੂਰ ਦੇ ਜ਼ਿਲ੍ਹੇ ਮੋੜ ਜੁ ਸੰਗਰੂਰ ਦੇ ਇੱਕ ਪਿੰਡ ਮੋੜ ਵਿੱਚ ਜਿਉਣਾ ਮੋੜ ਦਾ ਕਿੱਸਾ ਮਿਲਦਾ ਹੈ ਜਿਹੜਾ ਕਿ ਬਹੁਤ ਹੀ ਜ਼ਿਆਦਾ ਫੇਮਸ ਹੈ ਅਤੇ ਪੁਰਾਣੇ ਸਮੇਂ ਵਿੱਚ ਪੰਜਾਬ ਦਾ ਜਦੋਂ ਰਾਜ ਅਫ਼ਗਾਨ ਅਫ਼ਗਾਨਾਸਤਾਨੀਤਾਨ ਤੱਕ ਸੀ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕਰਿਆ ਹੈ ਉਸ ਰਾਜ ਬਾਰੇ ਵੀ ਕਿਤਾਬਾਂ ਵਿੱਚ ਲਿਖਿਆ ਅਤੇ ਬਜ਼ੁਰਗ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਸਿਖਾਉਂਦੇ ਹਨ ਜਿਹੜਾ ਸਿਖਾਉਣਾ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਜ਼ਰੂਰੀ ਮੰਨਿਆ ਜਾਂਦਾ ਹੈ ਜੇ ਸੰਗੀਤ ਦੇ ਖੇਤਰ ਵਿੱਚ ਮਨ ਦੇਖਿਆ ਜਾਵੇ ਤਾਂ ਪੰਜਾਬ ਦੇ ਲੋਕ ਗੀਤ ਜਿਵੇਂ ਸੰਮੀ ਟੱਪੇ ਪਾਏ ਜਾਂਦੇ ਆ ਅਤੇ ਇਹ ਬਹੁਤ ਹੀ ਪੁਰਾਣੇ ਸਮੇਂ ਤੋਂ ਚੱਲਦੇ ਨੇ ਪੰਜਾਬੀ ਲੋਕ ਪੰਜਾਬੀ ਪੰਜਾਬੀ ਗੀਤ ਗੀਤਕਾਰ ਅਤੇ ਗਾਉਣ ਵਾਲ਼ੇ ਇਸ ਨੂੰ ਗਾਉਂਦੇ ਹਨ